ਹੈਲੋ ਹਾਂਜੀ ਕੌਣ ਹਾਂਜੀ ਹਾਂਜੀ ਗੁਰਪ੍ਰੀਤ ਜੀ ਬੋਲੋ ਹਾਂਜੀ ਹਾਂਜੀ ਬੋਲੋ ਹਾਂਜੀ ਹਾਂਜੀ ਹਾਂਜੀ ਬੋਲੋ ਹਾਂਜੀ ਉਹ ਅੱਛਾ ਇਹਦੇ ਵਿੱਚ ਜੀ ਹੈਲੋ ਹੈਲੋ ਹੈਲੋ ਹਾਂਜੀ ਹਾਂਜੀ ਹਾਂਜੀ ਮੈਂ ਕਿਹਾ ਜੀ ਸਰ ਪੁਲਸ ਪ੍ਰਸ਼ਾਸਨ ਹੈ ਨਾ ਜੋ ਥੱਲੜੇ ਦੇ ਲੇਵਲ ਦਾ ਕੁਛ ਵੀ ਨਹੀਂ ਕਰ ਸਕਦਾ ਇਹਦੇ ਵਿੱਚ ਥੱਲੜੇ ਲੇਵਲ ਦੇ ਪ੍ਰਸ਼ਾਸਨ ਦੇ ਹੱਥ ਬੰਨੇ ਹੋਏ ਨੇ ਜੋ ਸਾਡੇ ਵੱਡੇ ਲੇਵਲ ਦੇ ਅਫਸਰ ਨੇ ਡੀ ਆਈ ਜੀ ਆਈ ਜੀ ਐੱਸ ਐੱਸ ਪੀ ਸਾਨੂੰ ਇਹਨਾਂ ਦੇ ਹੁਕਮਾਂ ਅਨੁਸਾਰ ਚੱਲਣਾ ਪੈਂਦਾ ਅਤੇ ਇਹਨਾਂ ਨੂੰ ਵੀ ਸਰਕਾਰਾਂ ਦੇ ਹੁਕਮਾਂ ਅਨੁਸਾਰ ਚੱਲਣਾ ਪੈਂਦਾ ਕਿਤੇ ਨਾ ਕਿਤੇ ਮੈਨੂੰ ਇਹ ਲੱਗਦਾ ਵੀ ਪ੍ਰਸ਼ਾਸਨ ਦਾ ਜਿਹੜਾ ਉਤਲੇ ਲੈਵਲ ਦਾ ਹਿੱਸਾ ਅਤੇ ਉਤਲੇ ਲੈਵਲ ਦਾ ਸਰਕਾਰ ਲੈਵਲ ਦਾ ਹਿੱਸਾ ਸਰਕਾਰ ਦੇ ਜੋ ਬਿਲਕੁਲ ਅਸੀਂ ਦੱਸ ਸਕਦੇ ਹਾਂ ਅਸੀਂ ਤਾਂ ਦੇਖੋ ਜਿਵੇਂ ਮੰਨ ਲਓ ਕੋਈ ਨਸ਼ਾ ਬਰਾਮਦ ਕਰ ਲਿਆ ਕਿਸੇ ਕੋਲੋਂ ਅਸੀਂ ਉਹ 'ਤੇ ਪਰਚਾ ਪਾਉਣ ਦੀ ਕੋਸ਼ਿਸ਼ ਕਰਦੇ ਹਾਂ ਅਤੇ ਉਹ ਪਰਚਾ ਪਾਉਣ ਤੋਂ ਪਹਿਲਾਂ ਹੀ ਸਾਨੂੰ ਕੋਈ ਫੋਨ ਆ ਜਾਂਦਾ ਕਿਸੇ ਐੱਮ ਪੀ ਦਾ ਫੋਨ ਆਏ ਗਿਆ ਕਿਸੇ ਐੱਮ ਐੱਲ ਏ ਦਾ ਫੋਨ ਆ ਗਿਆ ਕਿਸੇ ਮੰਤਰੀ ਦਾ ਫੋਨ ਆ ਗਿਆ ਭਾਈ ਇਹ ਸਾਡਾ ਬੰਦਾ ਇਹਨੂੰ ਛੱਡ ਦਿਓ ਦੱਸੋ ਨੀਚਲੇ ਲੈਵਲ ਦਾ ਪ੍ਰਸ਼ਾਸਨ ਕੀ ਕਰੂਗਾ ਸੋ ਗੱਲ ਹਾਂ ਇਹ ਸਰਕਾਰਾਂ ਦੀਆਂ ਕਮਜ਼ੋਰੀਆਂ ਨੇ ਜੀ ਇਹ ਸਰਕਾਰਾਂ ਦੀਆਂ ਕਮਜ਼ੋਰੀਆਂ ਨੇ ਸਭ ਤੋਂ ਵੱਡੀ ਕਮਜ਼ੋਰੀ ਸਰਕਾਰਾਂ ਦੀ ਹੈ ਦੇਖੋ ਪੋਲੀਟੀਸ਼ਨ ਦੀ ਕਮਜ਼ੋਰੀ ਹੁੰਦੀ ਹੈ ਜਿਹੜਾ ਉਹ ਆਪਣੀ ਵੋਟਾਂ ਦੇ ਸਵਾਰਥ ਪਿੱਛੇ ਜਿਹੜਾ ਭੋਲੇ ਭਾਲੇ ਲੋਕਾਂ ਨਾਲ ਧੋਖਾ ਕਰੀ ਜਾਂਦਾ ਸਭ ਤੋਂ ਮਤਲਬ ਮੇਨ ਰੂਲ ਮੇਨ ਰੋਲ ਉਹਨਾਂ ਦਾ ਹੀ ਹੈ ਨਹੀਂ ਪੁਲਸ ਪੁਲਸ ਤਾਂ ਹਰ ਰੋਜ਼ ਹੀ ਕੁਛ ਕ ਨਾ ਕੁਛ ਕਰਦੀ ਹੈ ਜੀ ਗੱਲ ਤਾਂ ਇਹ ਹੈ ਉਹ ਫੋਨ ਆ ਜਾਂਦੇ ਨੇ ਉੱਤੋਂ ਤਾਂ ਥੱਲੇ ਲੇਵਲ ਦਾ ਪ੍ਰਸ਼ਾਸਨ ਕੀ ਕਰੂਗਾ ਥੱਲੜੇ ਲੈਵਲ ਦੇ ਪ੍ਰਸ਼ਾਸਨ ਕਾਰਵਾਈ ਅਸੀਂ ਤਾਂ ਕਰਨ ਨੂੰ ਤਿਆਰ ਹੀ ਹੈ ਜੀ ਅਸੀਂ ਤਾਂ ਕਾਰਵਾਈ ਕਰਨ ਵਾਸਤੇ ਹੀ ਬੈਠੇ ਹਾਂ ਹਰ ਰੋਜ਼ ਦ ਦੋ ਤਿੰਨ ਕੇਸ ਫੜੇ ਜਾਂਦੇ ਨੇ ਜੀ ਹਰ ਰੋਜ਼ ਪੰਜਾਬ ਦੇ ਵਿੱਚ ਨਹੀਂ ਮੈਂ ਤੁਹਾਨੂੰ ਇੱਕ ਇੱਕ ਮਤਲਬ ਯਾਨੀ ਕਿ ਇੱਕ ਸਟੇਸ਼ਨ ਦੀ ਗੱਲ ਕਰ ਰਿਹਾ ਹਾਂ ਜਿੱਥੇ ਚੌਂਕੀ ਹੁੰਦੀ ਹੈ ਉਸ ਚੌਂਕੀ ਦੇ ਵਿੱਚ ਹਰ ਰੋਜ਼ ਇੱਕ ਜਾਂ ਦੋ ਕੇਸ ਫੜੇ ਜਾਂਦੇ ਨੇ ਨਸ਼ੇ ਦੇ ਅਤੇ ਤੁਸੀਂ ਪੰਜਾਬ ਦੇ ਵਿੱਚ ਦੇਖ ਲਓ ਕਿੰਨੀਆਂ ਚੌਂਕੀਆਂ ਨੇ ਕਿੰਨੇ ਥਾਣੇ ਨੇ ਦੇਖੋ ਸੋ ਐਸੀ ਗੱਲ ਨਹੀਂ ਹੈਗੀ ਵੀ ਨਸ਼ਾ ਫੜਿਆ ਨਹੀਂ ਜਾਂਦਾ ਨਸ਼ਾ ਫੜਿਆ ਜਾਂਦਾ ਠੀਕ ਹੈ ਨਾ ਜੀ ਅਤੇ ਉਹੀ ਗੱਲ ਹੈ ਵੀ ਸਾਨੂੰ ਥੱਲੜੇ ਲੈਵਲ ਦੇ ਕਿਸੇ ਸਰਪੰਚ ਦਾ ਫੋਨ ਆ ਗਿਆ ਕਿਸੇ ਪੰਚ ਦਾ ਫੋਨ ਆ ਗਿਆ ਅਸੀਂ ਉਹਨਾਂ ਦੀ ਨਹੀਂ ਮੰਨਦੇ ਉਹ ਉੱਤੋਂ ਫੋਨ ਕਰਾ ਦਿੰਦੇ ਨੇ ਉਹ ਸਿਸਟਮ ਐਸੇ ਤਰੀਕੇ ਨਾਲ ਸਾਰਾ ਹੈ ਜੋ ਪਲੀਟੀਕਲ ਨੇ ਖ਼ਰਾਬ ਕੀਤਾ ਹੋਇਆ ਨਹੀਂ ਤਾਂ ਨਸ਼ਾ ਤਾਂ ਥੋੜ੍ਹੇ ਦਿਨਾਂ ਵਿੱਚ ਹੀ ਹਟਾ ਦੇਈਏ ਅਸੀਂ ਠੀਕ ਹੈ ਜੀ